ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਸਿਹਤ ਸੰਭਾਲ ਤੱਕ ਪਹੁੰਚ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਪੰਜਾਬ 'ਚ ਇਹੋ ਜਿਹੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਹਸਪਤਾਲ ਜਿਹੜੇ ਹੈ ਉਹ ਬਹੁਤੇ ਬਾਹਰ ਨੇ ਸ਼ਹਿਰਾਂ ਦੇ ਵਿੱਚ ਹੈ ਜਾਂ ਨੇੜੇ ਹੈ ਪਰ ਸੜਕਾਂ ਬਹੁਤ ਅੱਛੀਆਂ ਹੈਗੀਆਂ ਜਿਹਦੇ ਕਰਕੇ ਸਾਡੇ ਦੇ ਲੋਕਾਂ ਨੂੰ ਪਹੁੰਚਣ 'ਚ ਕੋਈ ਦਿੱਕਤ ਨਹੀਂ ਹੁੰਦੀ ਸਰਕਾਰ ਵੱਲੋਂ ਇੱਕ ਸੌ ਅੱਠ ਨੰਬਰ ਵੈਨ ਦੇ ਰਾਹੀਂ ਪੇਸੇਂਟ ਨੂੰ ਪਹੁੰਚਾਇਆ ਜਾਂਦਾ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਸਿਹਤ ਸੁ ਮਤਲਬ ਜਿਹੜੇ ਲੋਕਾਂ ਕੋਲ ਵਹੀਕਲ ਹੈਗੇ ਆਪਦੇ ਵਹੀਕਲ 'ਤੇ ਵੀ ਜਾ ਸਕਦੇ ਹੈਗੇ ਤਾਂ ਪਹੁੰਚਣ ਲਈ ਬਹੁਤ ਘੱਟ ਟਾਈਮ ਲੱਗਦਾ ਹੈਗਾ ਤਾਂ ਪਿੰਡਾਂ ਦੇ ਵਿੱਚ ਆਸ਼ਾ ਵਰਕਰਸ ਏ ਐਨ ਐਮ ਜੀ ਐਨ ਐਮ ਹੋਰ ਬਹੁਤ ਸਾਰੇ ਮੁੱਢਲੇ ਸਿਹਤ ਕੇਂਦਰ ਬਣੇ ਹੋਏ ਹੈ ਕਾਫੀ ਪਿੰਡਾਂ ਦੇ ਰੂਰਲ ਜਿਹੜੇ ਪੇਂਡੂ ਹਸਪਤਾਲ ਆ ਉਹ ਬਣੇ ਹੋਏ ਹੈ ਅਤੇ ਕਮਿਊਨਿਟੀ ਹੈਲਥ ਅਫਸਰ ਬੈਠਦੀ ਹੈਗੀ ਹੈ ਤਾਂ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ ਹੈਗੀ ਅਤੇ ਸਿਹਤ ਸਹੂਲਤਾਂ ਪਹੁੰਚਣ 'ਚ ਕੋਈ ਮਤਲਬ ਲ ਲੇਟ ਨਹੀਂ ਹੋ ਰਿਹਾ ਕੋਈ ਪ੍ਰਭਾਵਿਤ ਨਹੀਂ ਹੋ ਰਿਹਾ ਸਗੋਂ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆ ਸੇਲ ਸਿਹਤ ਸਹੂਲਤਾਂ ਮਿਲ ਰਹੀਆਂ ਹੈਗੀਆਂ ਤਾਂ ਇਸ ਕਰਕੇ ਉੱਥੇ ਕੋ ਬਹੁਤਾ ਸਮਾਂ ਨਹੀਂ ਲੱਗਦਾ